ਖੁੱਲੇ ਪਾਣੀ ਦੇ ਵਿੱਚ ਤੈਰਾਕੀ ਕਰਨ ਲਈ ਆਪਣੇ ਆਪ ਨੂੰ ਸੁਰਕਸ਼ਿਤ ਰਹਿਣ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਵਰਤਣੇ ਪੈਂਦੇ ਹਨ ਆਪਣੇ ਬੋਡੀ ਨੂੰ ਹਰ ਵੇਲੇ ਹਰਕਤ ਵਿੱਚ ਰੱਖਣਾ ਪੈਂਦਾ ਹੈ ਅਤੇ ਸਾਹ ਨੂੰ ਵੀ ਸਹੀ ਟਾਈਮ 'ਤੇ ਕੱਢਣਾ ਅਤੇ ਛੱਡਣਾ ਪੈਂਦਾ ਹੈ ਤਾਂ ਕਿ ਪਾਣੀ ਦਾ ਜਿਹੜਾ ਸਕੋਪ ਸਾਡੇ ਦਿਲ ਵਿੱਚ ਜਾਂ ਸਾਡੇ ਸਰੀਰ 'ਚ ਐਂਟਰ ਹੋਣ ਦਾ ਨਾ ਰਹੇ ਆਪਣੇ ਆਪ ਨੂੰ ਮੂਵਮੈਂਟ 'ਚ ਰੱਖ ਕੇ ਤੈਰਾਕੀ ਕਰਨੀ ਚਾਹੀਦੀ ਹੈ ਔਰ ਜਿਹੜੀ ਤਿਲਕਣ ਵਾਲੀ ਜਗ੍ਹਾ ਹੈ ਉਥੋਂ ਬਚਣਾ ਚਾਹੀਦਾ ਹੈ